ਸੱਤ ਦਸੰਬਰ ਦੋ ਹਜ਼ਾਰ ਤਿੰਨ ਵੀਹ ਦਸੰਬਰ ਦੋ ਹਜ਼ਾਰ ਚਾਰ ਉੱਨੀ ਜਨਵਰੀ ਉੱਨੀ ਸੌ ਛੇਹੱਤਰ ਬਾਈ ਅਗਸਤ ਦੋ ਹਜ਼ਾਰ ਸੱਤ ਅਠਾਰਾਂ ਸਤੰਬਰ ਉੱਨੀ ਸੌ ਪਚਾਸੀ